ਮੈਂ ਕਈ ਤਰ੍ਹਾਂ ਦੇ ਚਿੱਤਰ ਬਣਾਉਂਦੀ ਰਹਿੰਦੀ ਹਾਂ ਇਹਨਾਂ ਵਿੱਚੋਂ ਇੱਕ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਣਾਇਆ ਸੀ ਜੋ ਕਿ ਥ੍ਰੀ ਡੀ ਪੇਂਟਿੰਗ ਸੀ ਸਾਡੇ ਜ਼ਿਲ੍ਹੇ ਵਿੱਚ ਇੱਕ ਆਰਟ ਸੈਮੀਨਾਰ ਹੋਇਆ ਸੀ ਅਤੇ ਮੈਂ ਉਸ ਵਿੱਚ ਭਾਗ ਲਿਆ ਸੀ ਸਾ ਮੈਂ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਸਾਰੇ ਸਾਰਿਆਂ ਨੂੰ ਮੇਰਾ ਇਹ ਪੇਂਟਿੰਗ ਬੜੀ ਹੀ ਪਸੰਦ ਆਈ ਉਹ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੋਈ ਸੀ ਅਤੇ ਮੈਂ ਉਸਨੂੰ ਮੋਤੀਆਂ ਨਾਲ ਸਜਾਇਆ ਹੋਇਆ ਸੀ ਸਾਰੇ ਲੋਕਾਂ ਨੇ ਮੇਰੀ ਤਾਰੀਫ ਕੀਤੀ ਸੀ ਮੇਰੇ ਮਾਤਾ ਪਿਤਾ ਨੂੰ ਮੇਰੇ 'ਤੇ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋਇਆ ਮੈਂ ਅਪ ਆਪਣੇ ਮਾਪੇ ਦੋਸਤ ਅਤੇ ਗਾਹਕਾਂ ਨੂੰ ਉਹਨਾਂ ਦੇ ਜਨਮਦਿਨ 'ਤੇ ਅਤੇ ਹੋਰ ਵੀ ਵਿਸ਼ੇਸ਼ ਮੌਕਿਆਂ ਅਤੇ ਪੇਂਟਿੰਗਜ਼ ਗਿਫਟ ਕਰਦੀ ਰਹਿੰਦੀ ਹਾਂ ਜਿਸ ਨਾਲ ਉਹ ਮੈਨੂੰ ਯਾਦ ਵੀ ਕਰ ਲੈਂਦੇ ਹਨ ਅਤੇ ਆਪਣੇ ਘਰ ਨੂੰ ਸੁੰਦਰ ਵੀ ਬਣਾ ਲੈਂਦੇ ਹਨ ਇਸ ਤੋਂ ਇਲਾਵਾ ਮੈਂ ਇੰਸਟਾਗ੍ਰਾਮ ਆਪਣੇ ਇੰਸਟਾਗ੍ਰਾਮ ਪੇਜ 'ਤੇ ਪੇਂਟਿੰਗਜ਼ ਨੂੰ ਵੇਚ ਵੀ ਦਿੰਦੀ ਹਾਂ ਅਤੇ ਕਾਫੀ ਲੋਕ ਔਡਰ ਮੇਰੇ ਤੋਂ ਔਡਰ ਕਰਦੇ ਰਹਿੰਦੇ ਹਨ ਇਸ ਨਾਲ ਮੈਂ ਕਈ ਪੈਸੇ ਕਮਾ ਲੈਂਦੀ ਹਾਂ ਅਤੇ ਇਹ ਮੇਰਾ ਆਮਦਨ ਦਾ ਇੱਕ ਸਾਧਨ ਹੈ